ਸਾਡੇ ਸੱਭਿਆਚਾਰ ਦੇ ਵਿੱਚ ਵਿਆਹ ਦੀ ਰਸਮ ਬਹੁਤ ਹੀ ਵਿਸਤ੍ਰਿਤ ਹੈ ਸਾਡੇ ਪਹਿਲਾਂ ਤਾਂ ਮੇਲ ਵਾਲੇ ਦਿਨ ਜਾਗੋ ਨਿਕਲਦੀ ਹੈ ਨਾਨਕੇ ਆਉਂਦੇ ਹਨ ਨਾਨਕ ਛੱਕ ਲਾਉਂਦੇ ਹਨ ਆ ਕੇ ਜਾਗੋ ਨੂੰ ਸਾਰੇ ਪਿੰਡ ਦੇ ਵਿੱਚ ਘੁੰਮਾਇਆ ਜਾਂਦਾ ਹੈ ਉਸ ਤੋਂ ਬਾਅਦ ਘਰ ਲਿਜਾਇਆ ਜਾਂਦਾ ਹੈ ਲੋਕ ਫੇਰ ਰਾਤ ਨੂੰ ਡੀ ਜੇ ਲਾ ਕੇ ਭੰਗੜਾ ਪਾਉਂਦੇ ਹਨ ਪਾਰਟੀ ਕਰਦੇ ਹਨ ਉਸ ਤੋਂ ਅਗਲੇ ਦਿਨ ਵਿਆਹ ਵਾਲੇ ਮੁੰਡੇ ਨੂੰ ਤਿਆਰ ਕੀਤਾ ਜਾਂਦਾ ਹੈ ਮੁੰਡੇ ਦੇ ਬੰਨ ਲੱਗਦਾ ਹੈ ਹਲਦੀ ਦਾ ਲੇਪ ਲਗਾ ਕੇ ਲਗਾਇਆ ਜਾਂਦਾ ਹੈ ਉਸ ਤੋਂ ਬਾਅਦ ਲਾੜੇ ਨੂੰ ਤਿਆਰ ਕਰਕੇ ਕੁੜੀ ਦੇ ਘਰ ਬਰਾਤ ਲੈ ਕੇ ਜਾਂਦੇ ਜਾਂਦੇ ਹਨ ਉਸ ਤੋਂ ਬਾਅਦ ਉਹਨਾਂ ਦੇ ਆਨੰਦ ਕਾਰਜ ਹੁੰਦੇ ਹਨ ਆਨੰਦ ਕਾਰਜ ਤੋਂ ਬਾਅਦ ਰੋ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਬਰਾਤ ਜਦੋਂ ਸ਼ਾਮ ਨੂੰ ਤੁਰਦੀ ਹੈ ਤਾਂ ਉਹ ਕੁੜੀ ਨੂੰ ਵਿਦਾ ਕਰਦੇ ਹਨ ਕੁੜੀ ਨੂੰ ਵਿਦਾ ਕਰਨ ਤੋਂ ਬਾਅਦ ਜਦੋਂ ਘਰ ਲਿਆ ਘਰ ਲਿਜਾਇਆ ਜਾਂਦਾ ਹੈ ਤਾਂ ਮੁੰਡੇ ਦੀ ਮਾਂ ਮੁੰਡੇ ਦੇ ਸਿਰ ਉੱਪਰੋਂ ਸੱਤ ਵਾਰ ਪਾਣੀ ਵਾਰ ਕੇ ਪੀਂਦੀ ਹੈ ਉਸ ਤੋਂ ਬਾਅਦ ਮੁੰਡੇ ਅਤੇ ਕੁੜੀ ਨੂੰ ਘਰ ਦੇ ਅੰਦਰ ਲਿਜਾਇਆ ਜਾਂਦਾ ਹੈ ਉਸ ਤੋਂ ਬਾਅਦ ਹੋਰ ਵੀ ਕਈ ਰਸਮਾਂ ਹੁੰਦੀਆਂ ਹਨ ਉਸ ਤੋਂ ਅਗਲੇ ਦਿਨ ਸਾਡੇ ਛਟੀਆਂ ਖੇਡੀਆਂ ਜਾਂਦੀਆਂ ਹਨ ਮੁੰਡਾ ਅਤੇ ਕੁੜੀ ਛਟੀਆਂ ਖੇਡਦੇ ਹਨ ਅਤੇ ਹੋਰ ਵੀ ਕਈ ਹੁੰਦੇ ਹਨ